ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਸਰਕਾਰੀ ਸਕੀਮਾਂ ਖੁੱਲ੍ਹੀਆਂ ਹੋਈਆਂ ਹਨ ਗਰੀਬ ਬੱਚਿਆਂ ਲਈ ਵੀ ਸਰਕਾਰੀ ਸਕੀਮਾਂ ਖੁੱਲ੍ਹੀਆਂ ਹੋਈਆਂ ਹਨ ਵਿਧਵਾ ਪੈਨਸ਼ਨ ਵੀ ਖੁੱਲ੍ਹੀਆਂ ਵਾ ਹੋਰ ਬੁਢਾਪਾ ਪੈਨਸ਼ਨ ਵੀ ਖੁੱਲ੍ਹੀਆਂ ਹੋਈਆਂ ਹਨ ਜੋ ਬੁਢਾਪੇ 'ਚ ਲੋਕਾਂ ਲੋਕਾਂ ਲੋਕ ਉਹਦਾ ਫਾਇਦਾ ਉਠਾ ਰਹੇ ਆ ਬੁਢਾਪਾ ਪੈਨਸ਼ਨ ਦੇ ਉਹਨਾਂ ਨੂੰ ਘਰ ਘਰ ਪੈਨਸ਼ਨਾਂ ਪਹੁੰਚ ਰਹੀਆਂ ਹਨ ਆਪਾਂ ਵੀ ਇਹਨਾਂ ਦਾ ਲਾਭ ਉਠਾ ਰਹੇ ਹਾਂ ਅਤੇ ਅੱਜ ਕੱਲ੍ਹ ਸਰਕਾਰ ਨੇ ਆਮ ਪਾਰਟੀ ਸਰਕਾਰ ਨੇ ਬਸ ਯਾਤਰਾ ਸ਼ੁਰੂ ਕੀਤੀਆਂ ਹਨ ਮੈਂ ਖੁਦ ਇੱਕ ਲੇਡੀਸ ਹੈਗੀ ਹਾਂ ਮੈਂ ਵੀ ਬਸ ਯਾਤਰਾ ਦਾ ਸਫਰ ਕੀਤਾ ਬਹੁਤ ਵਧੀਆ ਬੱਸ ਸਹੂਲਤਾਂ ਦਿੱਤੀਆਂ ਗਈਆਂ ਹਨ ਜੋ ਕਿ ਇੱਥੋਂ ਪੰਜਾਬ ਤੋਂ ਹਰਿਆਣਾ ਜਾਣਾ ਹੋਵੇ ਕੋਈ ਸਾਡਾ ਪੈਸਾ ਨਹੀਂ ਲੱਗਦਾ ਉਹ ਆਧਾਰ ਕਾਰਡ ਵੇਖ ਕੇ ਸਾਨੂੰ ਬਸ ਵਾਸਤੇ ਚੜ੍ਹਾ ਲੈਂਦੇ ਹਨ ਅਤੇ ਉੱਥੇ ਜਾ ਕੇ ਪਹੁੰਚਾ ਦਿੰਦੇ ਹਨ ਅਤੇ ਸਰਕਾਰੀ ਸਕੀਮਾਂ ਹੋਰ ਵੀ ਬਹੁਤ ਜ਼ਿਆਦਾ ਖੁੱਲ੍ਹੀਆਂ ਹੋਈਆਂ ਹਨ ਜਿਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਹੈ ਹੋਰ ਵੀ ਸਾਡੇ ਪੂਰੇ ਭਾਰਤ ਵਿੱਚ ਇੱਕ ਯਾਤਰਾ ਸਕੀਮ ਖੁੱਲ੍ਹੀ ਹੋਈ ਹੈ ਜੋ ਕਿ ਭਾਰਤ ਦਾ ਕੋਈ ਵੀ ਸਦੱਸਿਯ ਯਾਤਰਾ ਕਰ ਸਕਦਾ ਏ ਤੀਰਥਾਂ 'ਤੇ ਜਾ ਸਕਦਾ ਏ ਕੋਈ ਬੁਢਾਪੇ ਵੇਲੇ ਕੋਈ ਵੀ ਜਿੱਥੇ ਮਰਜ਼ੀ ਜਾ ਕੇ ਆਪਣਾ ਗੁਰੂ ਘਰ ਮੰਦਰਾਂ ਮਸਜਿਦ 'ਚ ਜਾ ਕੇ ਦਰਸ਼ਨ ਕਰਕੇ ਆਨੰਦਮਈ ਆਪਣਾ ਜੀਵਨ ਖੁਸ਼ਹਾਲ ਬਣਾ ਸਕਦਾ